ਤੇਈ ਜੂਨ ਉੱਨੀ ਸੌ ਤਰਾਸੀ ਛੇ ਮਈ ਉੱਨੀ ਸੌ ਅੱਠ ਪੱਚੀ ਸਤੰਬਰ ਦੋ ਹਜ਼ਾਰ ਅੱਠ ਸਤਾਰਾਂ ਅਗਸਤ ਉੱਨੀ ਸੌ ਉਨਾਸੀ ਦੋ ਜੂਨ ਉੱਨੀ ਸੌ ਚੁਰਾਸੀ